ਸ਼ੋਸ਼ਲ ਮੀਡੀਆ 'ਤੇ ਕੁਝ ਖਾਤੇ ਜਿਵੇਂ ਕਿ ਫੇਸਬੁੱਕ ਵਟਸਐਪ ਸਨੈਪਚੈਟ ਆਦਿ ਹਨ ਇਸ ਤੋਂ ਇਲਾਵਾ ਹੋਰ ਵੀ ਕੁਝ ਖਾਤੇ ਹਨ ਜੋ ਕਿ ਸ਼ੋਸ਼ਲ ਮੀਡੀਆ 'ਤੇ ਚਲਾਏ ਜਾਂਦੇ ਹਨ